ਪਰਿਵਾਰ ਹਾਸੋਂ ਹੀਣੀ ਗੱਲ ਹੈ ਪਹਿਲਾਂ ਹੁੰਦਾ ਸੀ ਪਰਿਵਾਰ ਇੱਕ ਪਰਿਵਾਰ ਦੇ ਵਿੱਚ ਪੰਦਰਾਂ ਪੰਦਰਾਂ ਵੀਹ ਵੀਹ ਨਿਆਣੇ ਜਿਹਨੂੰ ਅਸੀਂ ਅੱਜ ਕੱਲ੍ਹ ਕਿ ਇੱਕ ਮਜ਼ਾਕ ਬਣ ਕੇ ਰਹਿ ਗਿਆ ਇੱਕ ਪਰਿਵਾਰ ਦੇ ਅੰਦਰ ਇਕੱਠਾ ਪੂਰਾ ਜਿਹਨੂੰ ਕਹਿੰਦੇ ਸੀ ਸਾਂਝਾ ਪਰਿਵਾਰ ਅੱਜ ਕੱਲ੍ਹ ਹੋਟਲਾਂ ਵਿੱਚ ਵੀ ਲਿਖਿਆ ਜਾਂਦਾ ਸਾਂਝਾ ਚੁੱਲ੍ਹਾ ਇਹ ਸਾਂਝਾ ਚੁੱਲ੍ਹਾ ਕਦੋਂ ਸੀ ਜਦੋਂ ਪਰਿਵਾਰ ਇਕੱਠਾ ਸੀ ਹੁਣ ਪਰਿਵਾਰ ਸਾਰਾ ਬਿਖਰ ਗਿਆ ਅੱਜ ਕੱਲ੍ਹ ਮਾਂਵਾਂ ਭੈਣਾਂ ਦਾਦਾ ਦਾਦੀ ਨਾਨਾ ਨਾਨੀ ਉਹ ਤੋਂ ਬਾਅਦ ਲੋਕਾਂ ਦੀ ਸੋਚ ਕੀ ਰਹਿ ਗਈ ਸਾਡੇ ਕੋਲ ਪੈਸਾ ਨਹੀਂ ਹੈ ਅਸੀਂ ਪੰਜ ਨਿਆਣੇ ਜੰਮਤੇ ਉਹਨਾਂ ਨੂੰ ਕਮਾਵਾਂਗੇ ਕਿੱਥੇ ਖਵਾਵਾਂਗੇ ਕਿੱਥੇ ਕਿੱਥੇ ਸਾਂਭਾਗੇ ਇੱਕ ਬੱਚਾ ਇੱਕ ਮੁੰਡਾ ਜਾਂ ਕੁੜੀ ਪਰਿਵਾਰ ਮਾਸਾ ਮਾਸੀ ਮਾਮਾ ਚਾਚਾ ਨਾਨਾ ਦਾਦਾ ਪਾਪਾ ਸਭ ਖ਼ਤਮ ਤਾਇਆ ਚਾਚਾ ਮਾਮਾ ਕੌਣ ਰਹਿ ਗਿਆ ਅੱਜ ਤੋਂ ਬਾਅਦ ਇਹ ਸਾਰਾ ਕੁਛ ਖ਼ਤਮ